ਮੈਂ ਮਮਤਾ ਦੇਵੀ ਮਾਧੋਪੁਰ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਭਾਰਤ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਉਹਨਾਂ ਵਿੱਚੋਂ ਕੁਝ ਖੇਡਾਂ ਬੜੀਆਂ ਹੀ ਪ੍ਰਸਿੱਧ ਹਨ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਬੱਚਾ ਜਨਮ ਤੋਂ ਬਾਅਦ ਤੁਰਨਾ ਫਿਰਨਾ ਸਿੱਖਦਾ ਹੈ ਖੇਡਾਂ ਵਿੱਚ ਹੀ ਉਹ ਵੱਡਾ ਹੋ ਜਾਂਦਾ ਹੈ ਉਹ ਛੋਟੀਆਂ ਛੋਟੀਆਂ ਗੀਟੀਆਂ ਨਾਲ ਖੇਡਾਂ ਖੇਡਦਾ ਹੈ ਅਤੇ ਕਦੇ ਸਟਾਪੂ ਖੇਡਦਾ ਹੈ ਬੰਟਿਆਂ ਨਾਲ ਉਹ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈ ਕਦੀ ਉਹ ਪਕੜਨ ਪਕੜਾਈ ਵੀ ਖੇਡਦਾ ਹੈ ਇਸ ਤਰ੍ਹਾਂ ਉਹ ਹੌਲੀ ਹੌਲੀ ਉਹ ਜਵਾਨ ਹੋ ਜਾਂਦਾ ਹੈ ਭਾਰਤ ਵਿੱਚ ਖੇਡਾਂ ਦਾ ਬੜਾ ਹੀ ਅਹਿਮ ਰੋਲ ਹੈ ਖੇਡਾਂ ਸਾਡੇ ਜੀਵਨ ਵਿੱਚ ਬੜੀਆਂ ਹੀ ਮਹੱਤਵਪੂਰਨ ਹਨ ਜ਼ਿੰਦਗੀ ਵਿੱਚ ਜਿਹੜਾ ਬੰਦਾ ਖੇਡਾਂ ਖੇਡਦਾ ਹੈ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਇਹ ਗੱਲ ਬੜੀ ਪ੍ਰਸਿੱਧ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਜੇਕਰ ਅਸੀਂ ਗੱਲ ਕਰੀਏ ਕਿ ਭਾਰਤ ਦੇਸ਼ ਵਿੱਚ ਸਭ ਤੋਂ ਮਸ਼ ਮਸ਼ਹੂਰ ਅਥਲੀਟ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਮਿਲਖਾ ਸਿੰਘ ਭਾਰਤ ਦਾ ਸਭ ਤੋਂ ਪ੍ਰਸਿੱਧ ਅਥਲੀਟ ਹੈ ਉਸ ਨੂੰ ਦੌੜ ਵਿੱਚ ਆਪਣਾ ਨਾਮਣਾ ਖੱਟ ਕੇ ਪ੍ਰਸਿੱਧੀ ਹਾਸਿਲ ਕੀਤੀ ਹੈ ਅੱਜ ਕੱਲ੍ਹ ਕ੍ਰਿਕਟ ਵਿੱਚ ਵੀ ਬੜਾ ਅਹਿਮ ਰੋਲ ਹੈ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦਾ ਇਸ ਤਰ੍ਹਾਂ ਬੜੇ ਹੀ ਸਟਾਰ ਬੜੇ ਹੀ ਖਿਡਾਰੀ ਖੇਡਾਂ ਖੇਡ ਰਹੇ ਹਨ ਦੁਨੀਆ ਵਿੱਚ ਆਪਣੀ ਪ੍ਰਸਿੱਧੀ ਹਾਸਲ ਕਰ ਰਹੇ ਹਨ ਧੰਨਵਾਦ